ਸਤਿ ਸ਼੍ਰੀ ਅਕਾਲ ਜੀ ਜਿਹੜੀ ਸਾਡੀ ਪੰਜਾਬੀ ਭਾਸ਼ਾ ਏ ਆ ਉਹਦੀ ਜਿਹੜੀ ਰਚਨਾ ਏ ਆ ਉਹ ਸੰਸਕ੍ਰਿਤ ਦੇ ਸ਼ਬਦਾਂ ਤੋਂ ਅਤੇ ਮਤਲਬ ਕਿ ਬਹੁਤ ਜ਼ਿਆਦਾ ਸੰਸਕ੍ਰਿਤ ਦੇ ਸ਼ਬਦਾਂ ਤੋਂ ਲਿੱਤੀ ਗਈ ਹੈ ਕੁਛ ਉਰਦੂ ਫਾਰਸੀ ਦੀ ਵੀ ਯੂਜ਼ ਕੀਤੀ ਗਈ ਹੈ ਵਰਤੋਂ ਕੀਤੀ ਗਈ ਆ ਜਿਹੜੀ ਪੰਜਾਬੀ ਭਾਸ਼ਾ ਏ ਆ ਦੇਖਦਿਆਂ ਦੇਖਦਿਆਂ ਹੁਣ ਪੰਜਾਬੀ ਭਾਸ਼ਾ ਜਿਹੜੀ ਆ ਉਹ ਅਲੋਪ ਹੁੰਦੀ ਜਾ ਰਹੀ ਆ ਇੱਕ ਪੰਜਾਬੀ ਜਿਹੜਾ ਏ ਉਹ ਆਪਣੀ ਭਾਸ਼ਾ ਨਹੀਂ ਚੱਜ ਨਾਲ ਬੋਲ ਪਾ ਰਿਹਾ ਮਤਲਬ ਉਹ ਆਪਣੀ ਭਾਸ਼ਾ ਨੂੰ ਆਪਣੇ ਘਰ 'ਚ ਨਾ ਮਤਲਬ ਬੋਲਦਾ ਨਹੀਂ ਆ ਆਪਣੇ ਬੱਚਿਆਂ ਨੇ ਜੇ ਗੱਲ ਵੀ ਕਰਦਾ ਉਹ ਹਿੰਦੀ 'ਚ ਕਰਦਾ ਵਾ ਇੱਦਾਂ ਕਿਉਂ ਹੋਣ ਦਿਆ ਆ ਕਿਉਂਕਿ ਆਪਾਂ ਆਪਣੀ ਭਾਸ਼ਾ ਵੱਲ ਧਿਆਨ ਨਹੀਂ ਦੇਣ ਦੇ ਆਪਾਂ ਆਪਣੀ ਸੱਭਿਅਤਾ ਆਪਣੀ ਸੰਸਕ੍ਰਿਤੀ ਜਿਹੜੀ ਆ ਉਹ ਭੁੱਲਦੇ ਜਾਣ ਦੇ ਹਾਂ ਆਪਾਂ ਦੂਜਿਆਂ ਦੀ ਸੱਭਿਅਤਾ ਸੰਸਕ੍ਰਿਤੀ ਵਰਤ ਜਾਣ ਦੇ ਹਾਂ ਆਪਾਂ ਇੰਗਲਿਸ਼ 'ਚ ਤਾਂ ਆਪਣੇ ਬੱਚੇ ਨਾਲ ਗੱਲ ਕਰ ਲੈਂਦੇ ਹਾਂ ਪਰ ਪੰਜਾਬੀ ਨਾਲ ਨਹੀਂ ਕਰਦੇ ਕਿਉਂ ਕਿਉਂਕਿ ਅਸੀਂ ਮੋਡਰਨ ਹੋ ਗਏ ਹਾਂ ਨਾ ਤਾਂ ਕਰਕੇ ਹੁਣ ਆਪਾਂ ਆਪਣੀ ਭਾਸ਼ਾ ਦੀ ਵੀ ਜਦੋਂ ਗੱਲ ਕਰਦੇ ਨਾ ਆਪਾਂ ਆਪਣੀ ਭਾਸ਼ਾ ਵਿੱਚ ਵੀ ਥੋੜ੍ਹੀ ਬਹੁਤ ਨਾ ਚਾਹੁੰਦੇ ਹੋਏ ਵੀ ਅੰਗਰੇਜ਼ੀ ਵਾੜ ਹੀ ਦਿੰਦੇ ਹਾਂ ਕਿਉਂ ਵਾੜਦੇ ਹਾਂ ਆਦਤ ਆਲੇ ਦੁਆਲੇ ਜੋ ਸੁਣਦੇ ਹਾਂ ਉਹ ਆਦਤ ਪੈ ਗਈ ਆ ਹੁਣ ਆਪਾਂ ਆਪਣੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਾਂ ਮੈਂ ਚਾਹੁੰਦੀ ਹਾਂ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਨਾ ਉਹ ਵੀ ਮਤਲਬ ਕਿ ਬੋਲੀ ਜਾਵੇ ਕਿ ਜਿਹੜੀ ਪੰਜਾਬੀ ਜ ਜਿਹੜੇ ਹੈਗੇ ਨਾ ਉਹ ਤਾਂ ਆਪਣੇ ਘਰ 'ਚ ਆਪਣੀ ਪੰਜਾਬੀ ਭਾਸ਼ਾ ਨੂੰ ਬੋਲਣ ਅਤੇ ਪੰਜਾਬੀ ਭਾਸ਼ਾ ਦੀ ਮਾਨਯਤਾ ਜਿਹੜੀ ਆ ਉਹ ਹੋਰ ਵਧੇ ਪੰਜਾਬੀਆਂ ਦੀ ਵੀ ਪਛਾਣ ਵੱਖਰੀ ਹੁੰਦੀ ਆ ਪੰਜਾਬੀ ਤੋਂ ਬਿਨਾਂ ਪੰਜਾਬੀ ਕਾਹਦਾ